ਮੈਂ ਬਲਜਿੰਦਰ ਸਿੰਘ ਪਿੰਡ ਰਾਮਪੁਰ ਸਾਹੀਵਾਲ ਦਾ ਰਹਿਣ ਵਾਲਾ ਹਾਂ ਮੈਂ ਇੱਕ ਪਿੰਡ ਦਾ ਰਹਿਣ ਵਾਲਾ ਹਾਂ ਅਤੇ ਮੈਂ ਆਪਣਾ ਕਿੱਤਾ ਪਿੰਡ ਦੇ ਵਿੱਚ ਆਪਣੀ ਖੇਤੀ ਕਰਕੇ ਅਤੇ ਪਸ਼ੂ ਪਾਲਣ ਕਰਕੇ ਪਸ਼ੂ ਪਾਲ ਕੇ ਜਿਸ ਤਰ੍ਹਾਂ ਡੈਅਰੀ ਦਾ ਦੁੱਧ ਪਾ ਕੇ ਮੈਂ ਆਪਣਾ ਗੁਜ਼ਾਰਾ ਕਰਦਾ ਹਾਂ ਉਹਦੇ ਨਾਲ ਮੈਂ ਕਾਲਜ ਦੇ ਵਿੱਚ ਆਪਣੀ ਨੌਕਰੀ ਵੀ ਕਰਦਾ ਹਾਂ ਨੌਕਰੀ ਤੋਂ ਇਲਾਵਾ ਮੈਂ ਪਿੰਡਾਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਜੋ ਗਰੀਬ ਬੱਚੇ ਹਨ ਉਹਨਾਂ ਦੇ ਵਿੱਚੋਂ ਦੇਖ ਕੇ ਇੱਕ ਦੋ ਬੱਚਿਆਂ ਨੂੰ ਆਪਣੀ ਨੌਕਰੀ ਦੇ ਵਿੱਚੋਂ ਦਸਵੰਧ ਕੱਢ ਕੇ ਮੈਂ ਉਹਨਾਂ ਨੂੰ ਪੜ੍ਹਾ ਵੀ ਰਿਹਾ ਹਾਂ ਜਿਸ ਤਰ੍ਹਾਂ ਉਹਨਾਂ ਨੂੰ ਕਿਤਾਬਾਂ ਦੇ ਵਿੱਚ ਮਦਦ ਕਰਨੀ ਜਾਂ ਇਸ ਤਰ੍ਹਾਂ ਕੋਈ ਵੀ ਮਦਦ ਹੋਣ ਵਾਲੀ ਹੁੰਦੀ ਹੈ ਤਾਂ ਇਹ ਮੈਂ ਕਰਦਾ ਹਾਂ ਮੈਂ ਇਸ ਤਰ੍ਹਾਂ ਆਪਣਾ ਜੀਵਨ ਬਸਰ ਕਰਦਾ ਹਾਂ